ਹਰ ਸਪੋਰਟ ਵਿੱਚ ਮੈਡੀਕਲ ਟੀਮ ਦਾ ਬੜਾ ਵੱਡਾ ਸਹਿਯੋਗ ਹੈ ਕਿਉਂਕਿ ਮੈਡੀਕਲ ਟੀਮ ਜਿਹੜੀ ਹੈਗੀ ਆ ਉਹ ਉਹਦੇ ਬਿਨਾਂ ਸਪੋਰਟ ਹੋ ਹੀ ਨਹੀਂ ਸਕਦਾ ਕਿਉਂਕਿ ਇੱਦਾਂ ਹੈ ਕਿਉਂਕਿ ਹਰ ਹਰ ਜਿਹੜੀ ਗੇਮਾਂ ਵਾ ਉਹਦੇ ਵਿੱਚ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਚੋਟ ਲੱਗ ਜਾਂਦੀ ਹੈ ਅਤੇ ਸਰਕਾਰਾਂ ਉਹਨਾਂ ਲਈ ਮੈਡੀਕਲ ਟੀਮ ਲਿਆਉਂਦੀਆਂ ਹਨ ਅਤੇ ਉਹਨਾਂ ਦੀ ਕਾਫੀ ਦੇਖਭਾਲ ਕਰਦੀਆਂ ਨੇ ਮੈਡੀਕਲ ਟੀਮ ਹੈ ਕਿ ਅਗਰ ਉਸ ਨੂੰ ਕੋਈ ਛੋਟੀ ਚੋਟ ਲੱਗੀ ਹੋਵੇ ਅਤੇ ਉੱਥੇ ਉਸ ਦਾ ਇਲਾਜ ਹੋ ਜਾਂਦਾ ਅਗਰ ਉਸ ਨੂੰ ਕੋਈ ਵੱਡੀ ਚੋਟ ਲੱਗੀ ਹੋਵੇ ਤਾਂ ਉਹਨੂੰ ਹੋਸਪਿਟਲ ਜਾਂ ਹੋਰ ਕੋਈ ਜਗ੍ਹਾ 'ਤੇ ਉਹਦਾ ਟਰੀਟਮੈਂਟ ਹੁੰਦਾ ਮੈਡੀਕਲ ਟੀਮ ਹਰ ਗੇਮ ਵਿੱਚ ਕਾਫੀ ਹੋਣੀ ਚਾਹੀਦੀ ਹੈ ਕਿਉਂਕਿ ਮੈਡੀਕਲ ਟੀਮ ਤੋਂ ਬਿਨਾਂ ਗੇਮ ਹੋ ਹੀ ਨਹੀਂ ਸਕਦੀ ਅੱਜ ਦੇ ਟਾਈਮ ਵਿੱਚ ਕਿੰਨੇ ਮੈਚ ਇੱਦਾਂ ਹੁੰਦੇ ਨੇ ਕਿ ਜਿਹਦਾ ਵਿੱਚ ਕੀ ਹੈ ਪਲੇਅਰਾਂ ਨੂੰ ਚੋਟ ਲੱਗ ਜਾਂਦੀ ਹਨ ਅਤੇ ਉਹਨਾਂ ਦੀ ਮੈਡੀਕਲ ਟੀਮ ਤਿਆਰ ਰਹਿੰਦੀ ਹਨ ਉਹਨਾਂ ਨੂੰ ਉਹਨਾਂ ਦੀ ਕਰਦੀ ਚੈੱਕ ਕਰਦੀ ਹੈ ਅਗਰ ਉਹਨਾਂ ਨੂੰ ਕੋਈ ਵੱਡਾ ਇਸ਼ੂ ਨਹੀਂ ਹੈ ਅਤੇ ਉਹਨਾਂ ਨੂੰ ਉੱਥੇ ਸਹੀ ਕਰ ਦਿੰਦੇ ਆ ਅਤੇ ਅਗਰ ਵੱਡਾ ਇਸ਼ੂ ਹੈ ਤਾਂ ਉਹਨਾਂ ਨੂੰ ਹੋਸਪਿਟਲ ਲੈ ਕੇ ਚਲੇ ਜਾਂਦੇ ਹਨ ਇਹ ਸਰਕਾਰਾਂ ਦੀ ਬੜੀ ਵੱਡੀ ਵਧੀਆ ਚੀਜ਼ ਹੈ ਕਿ ਉਹਨਾਂ ਨੇ ਮੈਡੀਕਲ ਟੀਮ ਪ੍ਰੋਵਾਈਡ ਕੀਤੀ ਏ ਅੱਜ ਦੇ ਟਾਈਮ ਵਿੱਚ ਮੈਡੀਕਲ ਟੀਮ ਬਹੁਤ ਜ਼ਰੂਰੀ ਹੈ ਕਿ ਮੈਡੀਕਲ ਦੀ ਟੀਮ ਉਹਨਾਂ ਕੋਲ ਲਾਗੇ ਹੋਵੇ ਕਿਉਂਕਿ ਜ਼ਮਾਨੇ ਵਿੱਚ ਜਿੱਦਾਂ ਆਪਾਂ ਖੇਡਦੇ ਰਹੇ ਹਾਂ ਕ੍ਰਿਕਟ ਅਤੇ ਉਸ ਟਾਈਮ ਦੀ ਜਿਹੜੇ ਆਪਾਂ ਦੇਖਦੇ ਹੁੰਦੇ ਸੀ ਟੀ ਵੀਆਂ 'ਤੇ ਫੁੱਟਬੋਲ ਕ੍ਰਿਕਟ ਉਹਨਾਂ ਵਿੱਚ ਮੈਡੀਕਲ ਟੀਮ ਇੰਨੀ ਨਹੀਂ ਸੀ ਅਤੇ ਉਹਨਾਂ ਦੇ ਪਲੇਅਰਾਂ 'ਤੇ ਚੋਟ ਵੀ ਲੱਗਦੀ ਸੀ ਅਤੇ ਉਹਨਾਂ ਨੂੰ ਕਾਫੀ ਪ੍ਰੋਬਲਮ ਹੁੰਦੀ ਸੀ ਦਿੱਕਤ ਹੁੰਦੀ ਸੀ ਇਸ ਕਰਕੇ ਸਰਕਾਰ ਨੂੰ ਮੈਂ ਕਹਿਣਾ ਚਾਹਵਾਂਗਾ ਕਿ ਹਰ ਹਰ ਮਤਲਬ ਕਿ ਜਿਹੜੇ ਵੀ ਸਪੋਰਟਸ ਨੇ ਉਹਨਾਂ ਵਿੱਚ ਮੈਡੀਕਲ ਟੀਮ ਵਧੀਆ ਤੋਂ ਵਧੀਆ ਆਉਣੀ ਚਾਹੀਦੀ ਹਨ ਅਤੇ ਇਹੀ ਚੀਜ਼ ਹੈ ਮੈਡੀਕਲ ਟੀਮ ਪੰਜਾਬ ਮਤਲਬ ਕਿ ਸਪੋਰਟਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ